ਇੱਕ ਜਨਵਰੀ ਉੱਨੀ ਸੌ ਉਨਾਸੀ ਇੱਕ ਜੂਨ ਉੱਨੀ ਸੌ ਚੌਰਾਸੀ ਬਾਰਾਂ ਫਰਵਰੀ ਦੋ ਹਜ਼ਾਰ ਅੱਠ ਵੀਹ ਜਨਵਰੀ ਦੋ ਹਜ਼ਾਰ ਚੌਦਾਂ ਵੀਹ ਨਵੰਬਰ ਦੋ ਹਜ਼ਾਰ ਛੇ